ਹਾਂਜੀ ਸਤਿ ਸ਼੍ਰੀ ਅਕਾਲ ਜੀ ਜਾਗੋ ਦੇ ਲਈ ਦੇਖੋ ਜੀ ਆਪਾਂ ਪੰਜਾਬੀ ਟ੍ਰਡੀਸ਼ਨਲ ਆਪਾਂ ਜੇ ਗੱਲ ਕਰੀਏ ਤਾਂ ਮੇਨ ਜਿਹੜਾ ਹੈਗਾ ਆ ਤੁਹਾਡਾ ਜਿਹਾ ਉੱਚਾ ਜਿਹਾ ਕੁੜਤਾ ਅਤੇ ਨਾਲ਼ ਘੱਗਰਾ ਚੱਲ ਰਿਹਾ ਜੀ ਘੱਗਰਾ ਵਧੀਆ ਲੱਗਦਾ ਹੈ ਆ ਖੱਦਰ ਦਾ ਘੱਗਰਾ ਵੀ ਬਣਵਾ ਸਕਦੇ ਓ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਅੱਜ ਕੱਲ੍ਹ ਕਰੇਵ ਜਾਂ ਸਿਲਕ 'ਚ ਵੀ ਆ ਜਾਂਦਾ ਉਹ ਸੇਮ ਘੱਗਰਾ ਹਨਾਂ ਫੁੱਲਕਾਰੀ ਦਾ ਤੁਹਾਡਾ ਵਰਕ ਹੋਜੇਗਾ ਸ਼ਰਟ 'ਤੇ ਜਾਂ ਫਿਰ ਤੁਸੀਂ ਸਿੰਪਲ ਪਲੇਨ ਗੋਟਾ ਲਗਵਾਕੇ ਬਣਵਾ ਸਕਦੇ ਓ ਅਤੇ ਨਾਲ਼ ਫੁੱਲਕਾਰੀ ਇੱਕ ਸਾਈਡ 'ਤੇ ਤੁਸੀਂ ਲੈ ਸਕਦੇ ਓ ਫੁੱਲਕਾਰੀ ਇਹ ਜਿਹੜਾ ਮੇਨ ਚੱਲ ਰਿਹਾ ਜਿਹੜਾ ਘੱਗਰਾ ਚੱਲ ਰਿਹਾ ਜੇ ਤੁਸੀਂ ਫਿਰ ਘੱਗਰਾ ਨਹੀਂ ਲਾਈਕ ਕਰਦੇ ਤਾਂ ਪੰਜਾਬੀ ਸੂਟ ਵੀ ਥੋਡਾ ਬਣਜੇਗਾ ਤੰਗ ਸਲਵਾਰ ਵਾਲਾ ਹਨਾ ਸੂਟ ਜਿਹੜੇ ਪਹਿਲਾ ਚੱਲਦੇ ਹੁੰਦੇ ਸੀ ਏ ਸ਼ੇਪ ਦੇ ਤੰਗ ਸਲਵਾਰ ਦੇ ਨਾਲ਼ ਤੰਗ ਪੋਚਿਆਂ ਵਾਲੇ ਆਪਣੇ ਜਿਹੜੇ ਸੂਟ ਹੈ ਉਹ ਵੀ ਤੁਸੀਂ ਪਾ ਸਕਦੇ ਓ ਉਹ ਵੀ ਬਹੁਤ ਵਧੀਆ ਲੱਗਦੇ ਹੈ ਨਾਲ਼ ਥੋੜੀ ਪਰਾਂਦੀ ਹੋਜੇਗੀ ਨਾਲ਼ ਸੱਗੀ ਫੁੱਲ ਹੋਜੇਗਾ ਇਹ ਤੁਹਾਡਾ ਜਿਹੜਾ ਅੱਜ ਕੱਲ਼੍ਹ ਹਾਂਜੀ ਇਹ ਅਸੀਂ ਪੂਰਾ ਸੈਟ ਹੀ ਬਣਾਕੇ ਦਿੰਦੇ ਆ ਨਾਲ਼ ਪੰਜਾਬੀ ਜੁੱਤੀ ਸੱਗੀ ਫੁੱਲ ਨਾਲ਼ ਪਰਾਂਦੀ ਅਤੇ ਪੂਰੇ ਜਿਹੜੇ ਝੂੰਮਰ ਵਗੈਰਾ ਸਾਰਾ ਕੁਛ ਅਸੀਂ ਨਾਲ਼ ਦੇ ਦਿੰਦੇ ਆ ਜੀ ਫੁੱਲਕਾਰੀ ਦੇਖੋ ਜੀ ਵੈਸੇ ਜਿਹੜੀ ਪਹਿਲਾਂ ਚੱਲਦੀ ਸੀ ਖੱਦਰ ਤੇ ਚੱਲਦੀ ਸੀ ਉਹ ਵੀ ਬਹੁਤ ਵਧੀਆ ਲੱਗਦੀ ਆ ਜਿਹੜੀ ਟ੍ਰਡੀਸ਼ਨਲ ਲੁੱਕ ਦਿੰਦੀ ਆ ਖੱਦਰ ਅਤੇ ਅੱਜ ਕੱਲ਼੍ਹ ਚਨੋਣ 'ਤੇ ਵੀ ਆਉਣ ਲੱਗ ਗਈ ਆ ਫੁੱਲਕਾਰੀ ਉਹ ਵੀ ਬਹੁਤ ਵਧੀਆ ਲੱਗਦੀ ਆ ਜੀ ਤੁਸੀਂ ਕੋਈ ਵੀ ਫੁੱਲਕਾਰੀ ਕਰਵਾ ਸਕਦੇ ਓ ਸਾਡੀਆਂ ਹੱਥ ਦੀਆਂ ਬਣੀਆਂ ਫੁੱਲਕਾਰੀਆਂ ਨੇ ਸਾਰੀਆਂ ਜੀ ਕੋਈ ਮਸ਼ੀਨੀ ਫੁੱਲਕਾਰੀ ਨੀ ਹੋਏਗੀ ਸਾਰਾ ਹੱਥ ਦਾ ਕੰਮ ਹੋਏਗਾ ਜੀ ਹਾਂਜੀ ਹਾਂਜੀ ਬਿਲਕੁੱਲ ਥੋੜ੍ਹਾ ਕੋਸਟਲੀ ਤਾਂ ਹੋਏਗਾ ਜੀ ਦੇਖੋ ਥੋੜਾ ਕੋਸਟਲੀ ਚਲਿਆ ਜਾਂਦਾ ਕਿਉਂਕਿ ਹੱਥ ਦਾ ਕੰਮ ਏ ਇਸ ਕਰਕੇ ਸਾਰਾ ਕੋਸਟਲੀ ਚਲਿਆ ਜਾਂਦਾ ਬਟ ਚੀਜ਼ ਕਿਸੇ ਦੇ ਮਤਲਬ ਹੋਰ ਨੀ ਪਾਈ ਹੋਊਗੀ ਜਿਹੋ ਜਿਹੀ ਤੁਸੀਂ ਸਾਡੇ ਕੋਲੋ ਤਿਆਰ ਕਰਵਾਂਊਗੇ ਹਰ ਕੋਈ ਥੋਨੂੰ ਪੁੱਛੇਗਾ ਵੀ ਤੁਸੀਂ ਕਿੱਥੋ ਤਿਆਰ ਕਰਵਾਈ ਹੈ ਡਿਫਰੈਟ ਚੀਜ਼ ਹੋਏਗੀ ਜੀ ਬਿਲਕੁੱਲ ਬਜਟ ਦੇਖੋ ਜੇ ਤੁਸੀਂ ਚਨੋਣ 'ਤੇ ਫੁੱਲਕਾਰੀ ਬਣਵਾਣੀ ਉਹ ਛੇ ਕੁ ਹਜ਼ਾਰ ਰੁਪਏ ਦੀ ਬਣੇਗੀ ਜੇ ਤੁਸੀਂ ਬਾਗ਼ ਟਾਈਪ ਬਣਵਾਉਣੀ ਹੈ ਉਹ ਦਸ ਹਜ਼ਾਰ 'ਤੇ ਬਣਜੇਗੀ ਦਸ ਹਜ਼ਾਰ ਰੁਪਏ ਦੀ ਬਣੇਗੀ ਥੋਡੀ ਫੁੱਲਾਕਾਰੀ ਅਤੇ ਜੇ ਪੂਰਾ ਘੱਗਰਾ ਸੂਟ ਤੁਸੀਂ ਵਿੱਦ ਫੁੱਲਕਾਰੀ ਬਣਵਾਣਾ ਹੈ ਜੀ ਉਹ ਚੌਦਾਂ ਹਜ਼ਾਰ ਤੱਕ ਜਾਏਗਾ ਇਹਦਾ ਬਜਟ ਹਾਂਜੀ ਓਕੇ ਜੀ ਵੈਲਕੱਮ